ਭੰਗੜਾ ਭੰਗੜੇ ਦੀ ਮੱਥਬਾ ਮਹਤਬਾ ਕੀ ਇਕ ਸ਼ੌਂਕ ਇੱਕ ਖੁਸ਼ੀ ਇੱਕ ਇਵੇਂ ਭੰਗੜਾ ਪਾਉਣ ਨਾਲ ਇੱਕ ਸਰੀਰਕ ਤੌਰ 'ਤੇ ਬਹੁਤ ਵਧੀਆ ਮਹੱਤਵ ਕਸਰਤ ਆ ਇੱਕ ਐਸੇ ਭੰਗੜਾ ਪਾਉਣ ਨਾਲ ਮਨ ਨੂੰ ਖੁਸ਼ੀ ਸਹਿਣਸ਼ੀਲਤਾ ਅਤੇ ਰੌਣਕ ਜਿਵੇਂ ਕਿ ਆਪਾਂ ਕੋਈ ਫੰਕਸ਼ਨ ਕਰਦੇ ਹਾਂ ਆਪਾਂ ਨੱਚਦੇ ਗਾਉਂਦੇ ਹਾਂ ਭੰਗੜਾ ਪਾਉਂਦੇ ਹਾਂ ਆਪਾਂ ਹਰ ਇਕ ਗੱਲ ਦੇ ਵਿੱਚ ਇਹ ਕਹਿ ਦਿੰਦੇ ਹਾਂ ਇਹ ਖੁਸ਼ੀ ਦੀ ਗੱਲ ਹੁਣ ਪਾਓ ਭੰਗੜੇ ਭੰਗੜਾ ਇੱਕ ਵਧੀਆ ਅਤੇ ਚੰਗੀ ਚੀਜ਼ ਗਿਣਿਆ ਜਾਂਦਾ ਭੰਗੜੇ ਨਾਲ ਹਰੇਕ ਫੰਕਸ਼ਨ 'ਚ ਜ਼ਿਆਦਾ ਖੁਸ਼ੀ ਮਿਲਦੀ ਹੈ ਭੰਗੜਾ ਇੱਕ ਇਹੋ ਜਿਹੀ ਚੀਜ਼ ਹੈ ਕਿਉਂਕਿ ਕਿੰਨਾ ਮਨ ਉਦਾਸ ਹੈ ਭੰਗੜਾ ਪਾਉਂਦਿਆਂ ਨੂੰ ਦੇਖ ਕੇ ਮਨ ਖੁਸ਼ੀ 'ਚ ਉਠ ਖੜ੍ਹਦਾ ਖੁਸ਼ੀ ਮਨਾਉਂਦਾ ਅਤੇ ਇਕ ਤਰ੍ਹਾਂ ਮਨ 'ਚ ਕੋਈ ਦੁਖੀ ਵੀ ਹੁੰਦਾ ਨਾ ਭੰਗੜਾ ਪਾਉਂਦਿਆਂ ਨੂੰ ਦੇਖ ਕੇ ਮਨ ਖੁਸ਼ੀ ਵਿੱਚ ਹੋਰ ਹੀ ਜੀ ਖੁਸ਼ੀ ਜਿਹੀ ਆਉਂਦੀ ਹੈ ਅਤੇ ਰੋਣਕ ਜਿਹੀ ਮਹਿਸੂਸ ਹੁੰਦੀ ਹੈ ਇਹਨੂੰ ਕਹਿੰਦੇ ਭੰਗੜਾ ਨੱਚਣਾ ਨਾ ਭੰਗੜਾ ਪਾਉਣਾ ਨੱਚੋ ਗਾਓ ਖੁਸ਼ੀਆਂ ਮਨਾਓ ਭੰਗੜੇ ਪਾਓ ਇੱਕ ਇਹ ਟਾਈਮ ਵੀ ਆ ਅਤੇ ਸੁਣਨਾ ਵੀ ਬਹੁਤ ਹੀ ਚੰਗਾ ਲੱਗਦਾ ਹੈ